ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਲਿਬਾਸ ਟੇਲਰ ਤੋਂ ਗੱਲ ਕਰ ਰਹੇ ਰੋਪੜ ਹਾਂਜੀ ਮੈਮ ਠੀਕ ਹੈ ਜੀ ਮੈਮ ਮੈਂ ਨਾ ਆਪਣੇ ਮੈਂ ਸੁਣਿਆ ਸੀ ਤੁਹਾਡੀ ਸ਼ੌਪ ਦਾ ਨਾਮ ਅਤੇ ਮੈਂ ਆਪਣੇ ਕੱਪੜੇ ਵਗੈਰਾ ਸਟਿੱਚ ਕਰਵਾਉਣੇ ਸੀ ਅਤੇ ਕੀ ਤੁਸੀਂ ਮੈਨੂੰ ਆਪਣੀ ਦੱਸ ਸਕਦੇ ਹੋ ਕਿਵੇਂ ਕਿਸ ਤਰ੍ਹਾਂ ਦੇ ਕਿਹੜੇ ਡਿਜ਼ਾਈਨ ਦੇ ਤੁਸੀਂ ਆਪਣੇ ਕੱਪੜੇ ਸਿਲਾਈ ਕਰਦੇ ਹੋ ਠੀਕ ਹੈ ਮੈਮ ਅਤੇ ਉਹ ਮਤਲਬ ਲੈਸਿਸ ਵਗੈਰਾ ਤੁਸੀਂ ਹਾਂਜੀ ਅਤੇ ਠੀਕ ਹੈ ਮੈਮ ਲੈਸ ਵਗੈਰਾ ਤੁਸੀਂ ਆਪਣੀ ਉਹ ਲਗਾਉਂਦੇ ਹੋ ਜਾਂ ਤੁਹਾਨੂੰ ਮਤਲਬ ਅੱਛਾ ਜੀ ਅਤੇ ਮੈਮ ਤੁਸੀਂ ਮੈਨੂੰ ਸਟਿੱਚਿੰਗ ਦੱਸ ਸਕਦੇ ਹੋ ਸਿਲਾਈ ਕਿਹੜੇ ਕੀ ਹਿਸਾਬ ਹੈਗਾ ਹੈ ਲਾਇਨਿੰਗ ਅਤੇ ਵਿਦਆਊਟ ਲਾਇਨਿੰਗ ਹੋਵੇ ਹਾਂਜੀ ਹਾਂਜੀ ਅਤੇ ਕੀ ਕਿੰਨੀ ਕੁ ਸਿਲਾਈ ਹੋਵੇਗੀ ਇਹ ਸੂਟ ਦੀ ਮੈਮ ਜੇ ਮੈਂ ਸਿਮਪਲ ਸਿਲਵਾਵਾ ਠੀਕ ਹੈ ਜੀ ਠੀਕ ਹੈ ਅਤੇ ਮੈਮ ਕਿੰਨੇ ਕੁ ਦਿਨਾਂ ਤੱਕ ਮੈਨੂੰ ਸੂਟ ਰੇਡੀ ਹੋ ਕੇ ਪੂਰਾ ਸਿਲਾਈ ਹੋ ਕੇ ਮਿਲ ਮਿਲ ਸਕਦਾ ਹੈ ਠੀਕ ਹੈ ਮੈਮ ਮੇਰੇ ਨਾ ਮੇਰੇ ਭਾਈ ਦੀ ਹੈ ਭਾਈ ਦਾ ਵਿਆਹ ਹੈਗਾ ਸੀ ਅਤੇ ਇਸ ਕਰਕੇ ਮੈਂ ਕਾਫੀ ਸਾਰੇ ਸੂਟ ਤੁਹਾਡੇ ਤੋਂ ਸਿਲਵਾਉਣਾ ਚਾਹੁੰਦੀ ਸੀ ਮੈਂ ਤੁਹਾਡੀ ਦੁਕਾਨ ਦਾ ਨਾਮ ਸੁਣਿਆ ਸੀ ਰੋਪੜ ਦੇ ਵਿੱਚ ਅਤੇ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਸੂਟ ਇੱਕ ਪਹਿਲਾਂ ਤੁਹਾਡੇ ਤੋਂ ਸਿਲਵਾ ਕੇ ਦੇਖ ਲਵਾਂਗੀ ਨਾ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਮੇਰੇ ਸੂਟ ਸਟਿੱਚ ਕਰ ਦਿਓ ਸਾਰੇ ਹੀ ਹਾਂਜੀ ਅਤੇ ਠੀਕ ਹੈ ਮੈਮ ਠੀਕ ਹੈ ਅਤੇ ਮੈਮ ਤੁਸੀਂ ਮੈਨੂੰ ਆਪਣਾ ਐਡਰੈੱਸ ਵਗੈਰਾ ਫੋਨ ਨੰਬਰ ਵਗੈਰਾ ਕਰ ਦਿਉਂਗੇ ਸੈਂਡ ਅੱਛਾ ਜੀ ਠੀਕ ਹੈ ਅਤੇ ਮੈਮ ਮੈਂ ਐਵੇਂ ਪੁੱਛਣਾ ਸੀ ਕਿ ਇਹ ਕਿ ਜਿਹੜੀ ਤੁਹਾਡੀ ਦੁਕਾਨ ਹੈ ਅਤੇ ਇਹ ਕਿੱਥੇ ਕੁ ਨੂੰ ਇਹ ਹੈ ਰੋਪੜ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਠੀਕ ਹੈ ਅੱਛਾ ਮੈਮ ਅਤੇ ਤੁਸੀਂ ਹਾਂਜੀ ਅਤੇ ਤੁਸੀਂ ਮੈਮ ਮੈਂ ਇਹ ਪੁੱਛਣਾ ਸੀ ਪਠਾਣੀ ਸੂਟ ਅਤੇ ਅਨਾਰਕਲੀ ਸੂਟ ਬਣਾ ਦਿੰਦੇ ਹੋ ਅੱਛਾ ਮੈਮ ਉਹਦੇ ਲਈ ਮੈਂ ਇਹ ਪਤਾ ਕਰਨਾ ਸੀ ਕਿ ਉਹਦੇ ਵਿੱਚ ਕੱਪੜਾ ਕਿੰਨਾ ਕੁ ਲੱਗ ਜਾਏਗਾ ਮੇਰਾ ਅੱਛਾ ਅਤੇ ਮੈਮ ਕੱਪੜਾ ਕਿਸ ਮਤਲਬ ਕਿਵੇਂ ਦਾ ਹੋਣਾ ਚਾਹੀਦਾ ਹੈ ਕੋਟਨ ਵਗੈਰਾ ਜਿਵੇਂ ਮਰਜ਼ੀ ਦਾ ਹੋਵੇ ਅੱਛਾ ਠੀਕ ਹੈ ਮੈਮ ਅਤੇ ਮੈਮ ਮੈਂ ਨਾ ਇਹ ਬਣਵਾਉਣਾ ਚਾਹੁੰਦੀ ਹਾਂ ਜਿਵੇਂ ਫੁੱਲ ਘੇਰਾ ਹੋਵੇ ਅਤੇ ਨਾਲ ਲੈਸ ਵਗੈਰਾ ਵੀ ਤੁਸੀਂ ਹੀ ਲਗਵਾ ਦਿਓ ਮੇਰੀ ਵਧੀਆ ਜਿਹਾ ਲਾਈਕ ਕੰਟਰਾਸਟ ਕਰ ਹੁੰਦਾ ਹੈ ਨਾ ਜਿਵੇਂ ਸਲਵਾਰ ਸੂਟ ਦਾ ਹਾਂਜੀ ਅਤੇ ਕਿਉਂਕਿ ਮੈਨੂੰ ਐਨੀ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਅਤੇ ਮੈਨੂੰ ਤੁਸੀਂ ਦੱਸ ਦਿਓ ਕਿ ਕੀ ਇਸ ਦੇ ਨਾਲ ਕਿਹੜਾ ਕੰਟਰਾਸਟ ਲੱਗ ਸਕਦਾ ਹੈ ਹਾਂਜੀ ਹਾਂਜੀ ਮੈਮ ਮੈਨੂੰ ਦੱਸ ਦਿਓ ਜ਼ਰੂਰ ਠੀਕ ਹੈ ਮੈਮ ਤਾਂ ਫੇਰ ਚਾਰਜਿਸ ਇਹਦੇ ਕਿੰਨ੍ਹੇ ਸਿਲਾਈ ਦੇ ਪੈਸੇ ਕਿੰਨ੍ਹੇ ਹੋ ਸਕਦੇ ਹੈ ਕਿੱਥੇ ਕੁ ਤੱਕ ਹੋ ਸਕਦੇ ਹੈ ਹਾਂਜੀ ਹਾਂਜੀ ਠੀਕ ਹੈ ਮੈਮ ਠੀਕ ਹੈ ਅਤੇ ਮੈਮ ਮੈਂ ਆਵਾਂਗੀ ਦੋ ਤਿੰਨ ਦਿਨਾਂ ਵਿੱਚ ਤੁਹਾਡੀ ਸ਼ੌਪ 'ਤੇ ਵੀਜ਼ਿਟ ਆ ਜਾਵਾਂਗੀ ਕਰ ਲਵਾਂਗੀ ਵੀਜ਼ਿਟ ਅਤੇ ਮੇਰਾ ਇੱਕ ਵਾਰ ਇੱਕ ਇੱਕ ਫਸਟ ਸੂਟ ਤੁਸੀਂ ਮੈਨੂੰ ਇੱਕ ਸਿਲਵਾ ਕੇ ਦੇ ਦਿਓ ਠੀਕ ਹੈ ਮੈਮ ਠੀਕ ਹੈ ਠੀਕ ਹੈ ਮੈਮ ਠੀਕ ਐ ਮੈਮ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਓਕੇ ਜੀ